ਹੈਲੋ ਸਤਿ ਸ਼੍ਰੀ ਅਕਾਲ ਭਰਾ ਜੀ ਠੀਕ ਹੈ ਜੀ ਅੱਛਾ ਜੀ ਤੁਸੀਂ ਘੁੰਮਣ ਦੇ ਪੱਖ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ ਜੀ ਠੀਕ ਹੈ ਜੀ ਆਪਣੇ ਨਾ ਇਹ ਪੂਰਾ ਵਿਰਾਸਤੀ ਸ਼ਹਿਰ ਹੈ ਜੀ ਪਟਿਆਲਾ ਪੁਰਾਤਨ ਬਾਬਾ ਆਲਾ ਸਿੰਘ ਦੇ ਨਾਮ ਦੇ ਉੱਤੇ ਬਣਿਆ ਇਹ ਉਹ ਉਹਨਾਂ ਦੀ ਇਹ ਪੱਟੀ ਸੀਗੀ ਅਤੇ ਪੱਟੀਆਂ ਤੋਂ ਆਲਾ ਬਣਿਆ ਇਹ ਪਟਿਆਲਾ ਅਤੇ ਇੱਥੇ ਕਿਉਂ ਕਰਕੇ ਇਹਦਾ ਜਿਹੜਾ ਪੁਰਾਤਨ ਰੂਪ ਹੈ ਉਹ ਸਾਰਾ ਹੀ ਜਿੱਧਰ ਜਿੱਧਰ ਨੂੰ ਇਹਦੇ ਵਿੱਚ ਰਸਤੇ ਪੈਂਦੇ ਸੀ ਉਹਨਾਂ ਸਾਰੀ ਥਾਵਾਂ ਦੇ ਉੱਤੇ ਇਹਦੇ ਉੱਤੇ ਗੇਟ ਪੁਰਾਤਨ ਬਣੇ ਹੋਏ ਨੇ ਜਿਹੜੇ ਕਿ ਦੇਖਣ ਯੋਗ ਨੇ ਅਤੇ ਗਿਆਰਾਂ ਬਾਰਾਂ ਦੇ ਤਕਰੀਬਨ ਗੇਟ ਹੈਗੇ ਨੇ ਇੱਥੇ ਬਣੇ ਹੋਏ ਨੇ ਜੀ ਹਾਂਜੀ ਹਾਂ ਉਹਨਾਂ ਦੇ ਵਿੱਚ ਇੱਕ ਨਾਭਾ ਗੇਟ ਆ ਜੀ ਅਤੇ ਸ਼ੇਰਾਂ ਵਾਲਾ ਗੇਟ ਆ ਸਰਹੱਦੀ ਗੇਟ ਆ ਜੀ ਲਾਹੌਰੀ ਆ ਸੈਫਾਬਾਦੀਆ ਅਤੇ ਸਮਾਣੀਆਂ ਗੇਟ ਆ ਇਸ ਤੋਂ ਬਿਨਾਂ ਕਾਲੀ ਮਾਤਾ ਦਾ ਮੰਦਰ ਵੀ ਹੈਗਾ ਜੀ ਅਤੇ ਬਾਗਬਾਨੀ ਇੱਕ ਸਰਕਾਰੀ ਜੀ ਅਤੇ ਦੁਖਨਿਵਾਰਨ ਸਾਹਿਬ ਨੌਵੇਂ ਪਾਤਸ਼ਾਹ ਦਾ ਗੁਰਦੁਆਰਾ ਵੀ ਹੈਗਾ ਜੀ ਇੱਕ ਗੁਰਦੁਆਰਾ ਹੋਰ ਇਤਿਹਾਸਿਕ ਮੋਤੀ ਬਾਗ ਹਾਂ ਇਹਨਾਂ ਥਾਵਾਂ ਦੇ ਉੱਤੇ ਤੁਸੀਂ ਘੁੰਮ ਸਕਦੇ ਹੋ ਇਸ ਤੋਂ ਬਿਨਾਂ ਇੱਕ ਪੁਰਾਣਾ ਕਿਲ੍ਹਾ ਵੀ ਬਣਿਆ ਹੋਇਆ ਬਜ਼ਾਰ ਦੇ ਵਿੱਚ ਜੀ ਹਾਂ ਜੀ ਏ ਸੀ ਮਾਰਕੀਟ ਵੱਲ ਆ ਜੀ ਉਹ ਤੁਸੀਂ ਉ ਉਹ ਵੀ ਜਾ ਕੇ ਦੇਖ ਸਕਦੇ ਹੋ ਉੱਥੇ ਸ਼ਾਸਤਰ ਵਗੈਰਾ ਕਾਫ਼ੀ ਪਏ ਨੇ ਹਾਂਜੀ ਹਾਂ ਹਾਂ ਠੀਕ ਹੈ ਜੀ ਓਕੇ ਜੀ ਮਿਹਰਬਾਨੀ